ਭਾਰਤੀ ਰਾਜੀ ਰਾਜਨੀਤੀ ਹੈ ਜਿਹੜੀ ਉਹ ਬਹੁਤ ਸਿਆਸਤੀ ਪਾਰਟੀਆਂ ਦੇ ਨਾਲ ਭਰੀ ਹੋਈ ਰਾਜਨੀਤੀ ਹੈ ਜਿਹਦੇ ਵਿੱਚ ਕੀ ਹੈ ਜਿਹੜੇ ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਇੰਗੇਜਟ ਇੱਕ ਦੂਜੇ ਦੇ ਵਿਰੁੱਧ ਜਿਹੜੇ ਸ਼ੜਯੰਤਰ ਰਚ ਕੇ ਜਿਹੜੇ ਵਾਰ ਕਰ ਰਹੀਆਂ ਨੇ ਜਿਹਦੇ ਵਿੱਚ ਕੀ ਹੈ ਜਿਹੜੇ ਸਾਡੇ ਦੇਸ਼ ਦੇ ਭਾਰਤ ਦੇ ਲੋਕਤੰਤਰੀ ਗਣਰਾਜ ਨੇ ਜਿਹੜਾ ਉਹ ਪ੍ਰਭਾਵਿਤ ਕਰ ਰਹੀ ਆ ਜੇ ਅੱਜ ਦੀ ਘੜੀ ਦੇਖਿਆ ਜਾਵੇ ਤਾਂ ਇਹ ਜਿਹੜੀ ਮਾੜੀ ਰਾਜਨੀਤੀ ਹੋ ਰਹੀ ਹੈ ਜਿਹੜੀ ਸਾਡੇ ਭਾਰਤ ਦੇਸ਼ ਦੇ ਲਈ ਲੋਕਤੰਤਰ ਦੇ ਵੀ ਖਤਰਾ ਬਣ ਰਹੀ ਹੈ ਜਿਹਦੇ ਵਿੱਚ ਕੀ ਹੈ ਸਾਡਾ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਉਸ ਨੂੰ ਸਾਨੂੰ ਦੇਸ਼ ਦੇ ਵਿੱਚ ਸਰਕਾਰ 'ਚ ਉਹਨਾਂ ਦਾ ਜਿਹੜਾ ਅਧਿਕਾਰ ਹੈ ਉਸ ਨੂੰ ਖ਼ਤਮ ਕਰਨ ਦੀਆਂ ਜਿਹੜੀਆਂ ਯੋਜਨਾਵਾਂ ਚੱਲ ਰਹੀਆਂ ਨੇ ਜਿਵੇਂ ਦੇਖਿਆ ਜਾਵੇ ਸਾਡਾ ਜਿਹੜਾ ਲੋਕਤੰਤਰ ਹੈ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਅਸੀਂ ਆਪਣੀ ਮਨ ਪਸੰਦ ਜਿਹੜੀ ਸਰਕਾਰ ਹੈ ਅਸੀਂ ਆਪਣਾ ਉਸਨੂੰ ਚੁਣ ਸਕਦੇ ਹਾਂ ਪਰ ਜੇਕਰ ਜਿਵੇਂ ਈ ਵੀ ਐੱਮ ਮਸ਼ੀਨਾਂ ਦੇ ਵਿੱਚ ਹੋ ਰਹੀ ਘਪਲੇਬਾਜੀ ਅਤੇ ਜ਼ਬਰਦਸਤੀ ਪਵਾਈਆਂ ਜਾ ਰਹੀਆ ਵੋਟਾਂ ਪੈਸੇ ਦੇ ਕੇ ਲੋਕਾਂ ਨੂੰ ਖਰੀਦਿਆ ਜਾ ਰਿਹਾ ਦੇ ਨਾਲ ਕੀ ਆ ਸਾਡੇ ਭਾਰਤ ਦੇ ਜਿਹੜੇ ਲੋਕਾਂ ਦਾ ਜਿਹੜਾ ਲੋਕਤੰਤਰੀ ਗਣਰਾਜ ਆ ਲੋਕਤੰਤਰ ਨੂੰ ਡੈਮੋਕਰੇਸੀ ਨੂੰ ਖ਼ਤਮ ਕੀਤਾ ਜਾ ਰਿਹਾ ਤਾਂ ਜੇਕਰ ਦੇਖਿਆ ਜਾਵੇ ਅੱਜ ਦੀ ਘੜੀ ਸਾਰੇ ਨੇਤਾਵਾਂ ਦੇ ਵਿੱਚੋਂ ਜੇ ਮੇਰੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਰਾਜਨੇਤਾ ਦੇ ਵਿੱਚੋਂ ਸਭ ਤੋਂ ਵਧੀਆ ਰਾਜਨੇਤਾ ਇਸ ਸਮੇਂ ਰਾਹੁਲ ਗਾਂਧੀ ਜਿਹੜਾ ਦੇਸ਼ ਦੇ ਲਈ ਸਹੀ ਸਾਡੇ ਹਿਸਾਬ ਨਾਲ ਹੋ ਸਕਦਾ ਹੈ ਕਿਉਂਕਿ ਜੇਕਰ ਅੱਜ ਦੇ ਹਿਸਾਬ ਨਾਲ ਉਹਨਾਂ ਦਾ ਮੈਨੂਫੈਸਟੋ ਦੇਖਿਆ ਜਾਵੇ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਨੀਤੀਆਂ ਜਿਹੜਾ ਦੇਸ਼ ਨੂੰ ਚਲਾਉਣ ਦੇ ਲਈ ਵਰਤੀਆਂ ਗਈਆਂ ਨੇ ਤਾਂ ਜਿਹੜਾ ਜੇਕਰ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ ਜੇਕਰ ਉਹਨਾਂ ਨੂੰ ਇੱਕ ਵਾਰ ਵੀ ਮਿਲਦਾ ਹੈ ਤਾਂ ਮੈਂ ਇੱਕੋ ਗੱਲ ਉਹਨਾਂ ਨੂੰ ਪੁੱਛਾਂਗਾ ਜੇਕਰ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹੋ ਤਾਂ ਕੀ ਤੁਸੀਂ ਸਾਡੇ ਲੋਕਤੰਤਰ ਨੂੰ ਹਮੇਸ਼ਾ ਦੇ ਲਈ ਬਚਾ ਕੇ ਸੰਭਾਲ ਕੇ ਰੱਖ ਸਕਦੇ ਹੋ